ਹੈਲੋ ਹਾਂਜੀ ਗੁੰਜਨ ਦੱਸੀ ਏ ਗੁੰਜਨ ਮੈਂ ਨਾ ਕੁਛ ਤੁਹਾਡੇ ਨਾਲ ਡਿਸਕਸ ਕਰਨਾ ਸੀ ਮੈਂ ਨਾ ਆਪਣੇ ਬੇਟੇ ਦੀ ਅਡਮੀਸ਼ਨ ਕਰਵਾਉਣੀ ਹੈ ਔਰ ਉਹਦੇ ਬਾਰੇ ਕੀ ਸਕੂਲ ਮਤਲਬ ਕਿਹੜੇ ਸਕੂਲ 'ਚ ਕਰਵਾਈਏ ਅਤੇ ਉਸ ਬਾਰੇ ਡਿਸਕਸ ਤੁਹਾਡੇ ਨਾਲ ਕਰਨੀ ਸੀਗੀ ਓਕੇ ਓਕੇ ਹੂੰ ਠੀਕ ਹੈ ਐਚੁਲੀ ਇਹ ਹੈ ਕੀ ਮੈਂ ਕਾਫ਼ੀ ਲੋਕਾਂ ਨਾਲ ਗੱਲ ਕੀਤੀ ਹੈ ਇਸ ਬਾਰੇ ਆਰਮੀ ਸਕੂਲ ਦਾ ਇਹ ਹੈ ਹੁਣ ਕਿ ਪਹਿਲੇ ਕਾਫ਼ੀ ਜ਼ਿਆਦਾ ਡਸਿਪਲਨ ਸੀ ਐਥੇ ਬੱਟ ਹੁਣ ਕਹਿ ਰਹੇ ਹੈ ਥੋੜ੍ਹਾ ਜਿਹਾ ਨਾ ਲਿਨੀਐਂਟ ਹੋ ਗਿਆ ਮੈਂ ਕੌਨਵੈਂਟ 'ਚ ਵੀ ਮਤਲਬ ਵਿਊਜ਼ ਲਏ ਹੈ ਲੋਕਾਂ ਦੇ ਕਿ ਉਨ੍ਹਾਂ ਦੇ ਐਚੁਲੀ ਪਿੱਛੇ ਜਾ ਰਹੇ ਹੈ ਬੱਟ ਕੌਨਵੈਂਟ 'ਚ ਕੀ ਹੈ ਕਿ ਕੇਅਰ ਨਹੀ ਹੈਂ ਔਰ ਪ੍ਰੈਸ਼ਰਾਈਜ ਬਹੁਤ ਕੀਤਾ ਜਾਂਦਾ ਨਾ ਆਈ ਸੀ ਐੱਸ ਸੀ ਉਹਦੇ ਆਈ ਸੀ ਐੱਸ ਸੀ ਬੋਰਡ ਹੈ ਔਰ ਬੱਚੇ 'ਤੇ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਮੈਂ ਨਹੀਂ ਚਾਹੁੰਦੀ ਕਿ ਮੈਂ ਆਪਣੇ ਬੇਟੇ 'ਤੇ ਇੰਨਾ ਪ੍ਰੈਸ਼ਰ ਪਾਵਾਂ ਹੂੰ ਬਿਲਕੁਲ ਹਾਂਜੀ ਮੈਂ ਐਚੁਲੀ ਇਹੀ ਸੋਚ ਰਹੀ ਸੀ ਕੀ ਮੈਂ ਕਰਕੇ ਅਡਮੀਸ਼ਨ ਕਰਵਾ ਦਿਆਂ ਕਿਉਂਕਿ ਵੈਸੇ ਵੀ ਅੱਛਾ ਹਾਂਜੀ ਕਾਫ਼ੀ ਮਤਲਬ ਲੋਕਾਂ ਨੇ ਆਪਣੇ ਬੱਚਿਆਂ ਨੂੰ ਭੇਜਿਆ ਹੋਇਆ ਓਧਰ ਔਰ ਸੈਟਿਸਫਾਈਡ ਵੀ ਨੇ ਸਟੱਡੀ ਤੋਂ ਵੀ ਕੇਅਰ ਵੀ ਹੈ ਪੂਰੀ ਟੀਚਰਸ ਵੀ ਕਾਫ਼ੀ ਕੇਅਰਿੰਗ ਹੈ ਓਥੋਂ ਦੇ ਹਾਂਜੀ ਹਾਂਜੀ ਬਿਲਕੁਲ ਉਹ ਕਰੀਕੁਲਰ ਐਕਟਿਵਿਟੀਜ ਵੀ ਹਾਂਜੀ ਓਧਰ ਬਹੁਤ ਸਹੀ ਨੇ ਹੈ ਨਾ ਬਿਲਕੁਲ ਚਲੋ ਬਸ ਠੀਕ ਹੈ ਗੁੰਜਨ ਥੈਂਕ ਯੂ ਬਸ ਮੈਂ ਇਹੀ ਪੁੱਛਦੀ ਸੀ ਚਲੋ ਫੇਰ ਸਰਵਿਸਕਾਰੀ ਸਕੂਲ ਹੀ ਫਾਈਨਲ ਹੈ ਬਸ ਮੈਂ ਓਧਰ ਹੀ ਕਰਵਾਉਣ ਚੱਲੀ ਹਾਂ ਅਡਮੀਸ਼ਨ ਠੀਕ ਹੈ ਓਕੇ